ਜਿੱਦਾਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਭੰਗੜਾ ਸਾਡਾ ਇਕ ਲੋਕ ਨਾਚ ਹੈ ਅੱਜ ਕੱਲ੍ਹ ਸਾਰੇ ਹੀ ਆਪਣੀ ਸਿਹਤ ਨੂੰ ਵਧੀਆ ਰੱਖਣ ਲਈ ਭੰਗੜਾ ਐਰੋਬਿਕਸ ਜ਼ਰੂਰ ਕਰਦੇ ਹਨ ਜਿੱਦਾਂ ਕਿ ਮੈਂ ਆਪਣੀ ਉਦਾਹਰਣ ਹੀ ਲੈ ਸਕਦੀ ਆਂ ਕਿ ਮੈਨੂੰ ਵੀ ਪਹਿਲੇ ਬੀਪੀ ਦੀ ਪ੍ਰੋਬਲਮ ਸੀ ਇੱਕ ਜਦੋਂ ਤੋਂ ਮੈਂ ਭੰਗੜਾ ਐਰੋਬਿਕਸ ਸ਼ੁਰੂ ਕੀਤਾ ਹੈ ਉਦੋਂ ਤੋਂ ਮੇਰੀਆਂ ਬੀਪੀ ਦੀ ਪ੍ਰੋਬਲਮ ਕੀ ਹੋਰ ਵੀ ਥਕਾਵਟ ਮੈਨੂੰ ਬਹੁਤ ਹੋ ਜਾਂਦੀ ਸੀ ਉਹ ਵੀ ਹੌਲੀ ਹੌਲੀ ਸਭ ਕੁਝ ਦੂਰ ਹੋਣ ਲੱਗ ਪਿਆ ਸਾਡੇ ਘਰ ਦੇ ਸਾਹਮਣੇ ਇਕ ਪਾਕ ਵੀ ਹੈ ਉੱਥੇ ਵੀ ਸਾਰੇ ਬੱਚੇ ਬਜ਼ੁਰਗ ਜਵਾਨ ਸਾਰੇ ਹੀ ਭੰਗੜਾ ਐਰੋਬਿਕਸ ਨਾਲ ਜੁੜੇ ਆ ਜਿਹਦੇ ਨਾਲ ਕਿ ਉਹਨਾਂ ਦਾ ਟਾਈਮ ਪਾਸ ਵੀ ਹੋ ਜਾਂਦਾ ਹੈ ਅਤੇ ਉਹਨਾਂ ਦੀ ਸਿਹਤ ਵਿੱਚ ਵੀ ਬਹੁਤ ਵਾਧਾ ਕਰਦਾ ਹੈ ਅਸੀਂ ਤੰਦਰੁਸਤ ਵੀ ਰਹਿੰਦੇ ਹਾਂ ਅਤੇ ਸਾਡੀ ਪਾਚਨ ਸ਼ਕਤੀ ਵੀ ਇਹਦੇ ਨਾਲ ਬਿਲਕੁਲ ਫੁਰਤੀਲੀ ਅਸੀਂ ਫੁਰਤੀਲੇ ਵੀ ਰਹਿੰਦੇ ਹਾਂ ਪਾਚਨ ਸ਼ਕਤੀ ਵੀ ਇਹਦੇ ਨਾਲ ਬਹੁਤ ਵਧੀਆ ਰਹਿੰਦੀ ਹੈ ਮੈਂ ਤਾਂ ਚ ਕਹਿੰਦੀ ਹਾਂ ਕਿ ਸਾਨੂੰ ਸਭ ਨੂੰ ਭੰਗੜਾ ਐਰੋਬਿਕਸ ਜ਼ਰੂਰ ਕਰਨੀ ਚਾਹੀਦੀ ਹੈ ਇਸ ਨਾਲ ਹੋਰ ਵੀ ਬਹੁਤ ਸਾਰੇ ਫਾਇਦੇ ਹੁੰਦੇ ਹਨ ਜਿਹਦੇ ਨਾਲ ਅਸੀਂ ਜ਼ਿਆਦਾਤਰ ਥਕਦੇ ਨਹੀਂ ਸਾਡਾ ਸਰੀਰ ਫੁਰਤੀਲਾ ਰਹਿੰਦਾ ਹੈ ਹੋਰ ਵੀ ਇਹਦੇ ਨਾਲ ਬੜੇ ਫਾਇਦੇ ਹਨ ਸਾਨੂੰ ਡਾਂਸ ਭੰਗੜਾ ਸਭ ਕੁਝ ਬੜੇ ਵਧੀਆ ਤਰੀਕੇ ਨਾਲ ਕਰਨਾ ਚਾਹੀਦਾ ਹੈ ਬੱਚਿਆਂ ਲਈ ਵੀ ਇਹ ਬਹੁਤ ਫਾਇਦੇਮੰਦ ਚੀਜ਼ ਹੈ ਅਤੇ ਬਜ਼ੁਰਗਾਂ ਲਈ ਵੀ ਇਹ ਬਹੁਤ ਫਾਇਦੇਮੰਦ ਚੀਜ਼ ਹੈ ਧੰਨਵਾਦ